ਪੰਜਾਬ ਦਾ ਮੌਸਮ ਵੈਸੇ ਤਾਂ ਜੀ ਹਰੇਕ ਮੌਸਮ ਘੁੰਮਣ ਫਿਰਨ ਦੇ ਸੈਲਾਨੀਆਂ ਲਈ ਅਨੁਕੂਲ ਹੈ ਜੀ ਵੈਸੇ ਫੇਰ ਵੀ ਜੇ ਦੇਖਿਆ ਜਾਵੇ ਸੈਲਾਨੀਆਂ ਨੂੰ ਬਰਸਾਤ ਦੇ ਮੌਕੇ ਥੋੜ੍ਹਾ ਜਿਹਾ ਘੱਟ ਆਉਣਾ ਚਾਹੀਦਾ ਬਾਕੀ ਹਰ ਤਰ੍ਹਾਂ ਦਾ ਮੌਸਮ ਸਾਰਾ ਵਾਤਾਵਰਨ ਵਧੀਆ ਜੀ ਕਿਸੇ ਵੀ ਟੈਮ ਸਮੇਂ ਕੋਈ ਮੇਲਾ ਮੇਲੇ 'ਚ ਵਧੀਆ ਮਤਲਬ ਮੌਸਮ ਦਾ ਕੋਈ ਇੱਦਾਂ ਨਹੀਂ ਹੈ ਵੀ ਇਸੇ ਮੌਸਮ 'ਚ ਆਉਣਾ ਸਾਰੇ ਤਰ੍ਹਾਂ ਦਾ ਹਰ ਤਰ੍ਹਾਂ ਦਾ ਮੌਸਮ ਵਧੀਆ ਏ ਪੰਜਾਬ ਦਾ ਕਿਸੇ ਵੀ ਮੌਸਮ 'ਚ ਸੈਲਾਨੀ ਆ ਸਕਦੇ ਹੈ ਸਭ ਤੋਂ ਵਧੀਆ ਹੈ ਜੀ ਹਾਂਜੀ